ਹੈਲੋ ਸਤਿ ਸ਼੍ਰੀ ਅਕਾਲ ਜੀ ਗੁਰਜੰਟ ਸਿੰਘ ਗੱਲ ਕਰ ਰਿਹਾ ਜੀ ਹਾਂਜੀ ਉਬਰ ਤੋਂ ਗੱਲ ਕਰ ਰਹੇ ਜੀ ਹਾਂਜੀ ਉ ਅਸੀਂ ਨਾ ਤੁਹਾਡੇ ਤੋਂ ਅੱਧਾ ਕ ਗੱਡੀ ਆਡਰ ਕੀਤੀ ਸੀ ਅੱਧਾ ਘੰਟਾ ਪਹਿਲਾਂ ਕਿਤੇ ਜਾਣ ਵਾਸਤੇ ਅਸੀਂ ਪ੍ਰੋਗਰਾਮ ਪਲਾਨ ਕੀਤਾ ਸੀ ਚੰਡੀਗੜ੍ਹ ਘੁੰਮਣ ਦਾ ਕੁੱਲੂ ਮਨਾਲੀ ਘੁੰਮਣ ਦਾ ਹਿਮਾਚਲ ਘੋਮਨ ਘੁੰਮਣ ਦਾ ਕੁਛ ਦਿਨਾਂ ਦਾ ਪਲਾਨ ਸੀ ਸਾਡਾ ਚਾਰ ਪੰਜ ਯਾਰਾਂ ਦੋਸਤਾਂ ਦਾ ਅਤੇ ਤੁਹਾਡੀ ਗੱਡੀ ਪਹੁੰਚ ਚੁੱਕੀ ਆ ਸਾਡੇ ਕੋਲ ਅਤੇ ਗੱਡੀ ਦੀ ਹਾਲਤ ਜਿਹੜੀ ਆ ਨਾ ਉਹ ਬਹੁਤ ਜ਼ਿਆਦਾ ਮਾੜੀ ਹੈ ਜਿਸ ਦੀਆਂ ਕਿ ਸੀਟਾਂ ਬਹੁਤ ਜ਼ਿਆਦਾ ਗੰਦੀਆਂ ਫਟੀਆਂ ਕੁਛ ਅਤੇ ਟਾਇਰ ਆ ਟਾਇਰ ਵੀ ਸਾਰੇ ਬਹੁਤ ਹੀ ਖਰਾਬ ਜਿਹੇ ਆ ਇਹਦੇ ਟਾਇਰ ਬਹੁਤ ਘਸੇ ਹੋਏ ਆ ਸਾਡਾ ਸਫਰ ਲੰਬਾ ਹੋਣ ਕਰਕੇ ਅਸੀਂ ਇਹ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤਾਂ ਕਿਰਪਾ ਕਰਕੇ ਨਾ ਇਹਦਾ ਥੋੜ੍ਹਾ ਜਿਹਾ ਗੱਡੀ ਸਾਨੂੰ ਕੋਈ ਵਧੀਆ ਭੇਜੋ ਅਤੇ ਜਾਂ ਫਿਰ ਜੇ ਨਹੀਂ ਤੁਸੀਂ ਕੋਈ ਵਧੀਆ ਗੱਡੀ ਭੇਜ ਸਕਦੇ ਤਾਂ ਫਿਰ ਸਾਨੂੰ ਸਾਡਾ ਜਿਹੜਾ ਆਰਡਰ ਆ ਉਹ ਕੈਂਸਲ ਕਰ ਦਿਓ ਕਿਉਂਕਿ ਕੋਈ ਵੀ ਇਹਦੇ ਵਿੱਚ ਬਹਿਣ ਨੂੰ ਮੇਰਾ ਯਾਰ ਦੋਸਤ ਤਿਆਰ ਨਹੀਂ ਹੈਗਾ ਅਤੇ ਹਾਂਜੀ ਇਹ ਸੋ ਕਿਰਪਾ ਕਰਕੇ ਸਾਡੇ 'ਤੇ ਮਿਹਰਬਾਨੀ ਕਰਕੇ ਤਾਂ ਇਹਦੇ ਵੱਲ ਧਿਆਨ ਦਿਓ ਅਤੇ ਜਾਂ ਸਾਨੂੰ ਕੋਈ ਗੱਡੀ ਨਵੀਂ ਭੇਜੋ ਬਿਲਕੁਲ ਨਵੀਂ ਠੀਕ ਹੈ ਜੀ ਮਿਹਰਬਾਨੀ